ਮੈਂ ਆਰ ਆਰ ਇੰਸਟੀਟਿਊਟ ਸਰਹੰਦ ਵਿਖੇ ਕੁਕਿੰਗ ਕਲਾਸਾਂ ਵਿੱਚ ਭਾਗ ਲਿਆ ਮੇਰੇ ਮੈਡਮ ਦਾ ਨਾਮ ਰੀਤੂ ਮੈਮ ਸੀ ਸਾਨੂੰ ਰੋਜ਼ ਦੋ ਡਿਸ਼ਾਂ ਬਣਾਉਣੀਆਂ ਸਿਖਾਈਆਂ ਜਾਂਦੀਆਂ ਸਨ ਮੈਡਮ ਪਹਿਲਾਂ ਸਾਨੂੰ ਡਿਸ਼ ਬਾਰੇ ਪੂਰੀ ਜਾਣਕਾਰੀ ਦਿੰਦੇ ਫਿਰ ਉਸਨੂੰ ਬਣਾਉਣ ਲਈ ਜੋ ਵੀ ਸਾਵਧਾਨੀਆਂ ਵਰਤੀਆਂ ਜਾਂਦੀਆਂ ਉਹਨਾਂ ਬਾਰੇ ਦੱਸਦੇ ਕਿਹੜਾ ਮਸਾਲਾ ਕਿੰਨਾਂ ਪਾਉਣਾ ਹੈ ਡਿਸ਼ ਵਿੱਚ ਉਸਦੀ ਕੀ ਰੇਸ਼ੋ ਹੈ ਦੱਸਣ ਮਗਰੋਂ ਸਾਨੂੰ ਡਿਸ਼ ਬਣਾ ਕੇ ਦਿਖਾਉਂਦੇ ਫਿਰ ਅਸੀਂ ਉਸ ਡਿਸ਼ ਨੂੰ ਆਪ ਬਣਾ ਕੇ ਦੇਖਦੇ ਮੈਂ ਸ਼ਾਹੀ ਪਨੀਰ ਰਸਗੁੱਲੇ ਗੋਲ ਗੱਪੇ ਕੇਕ ਸਮੋਸੇ ਕਚੌਰੀਆਂ ਗਾਜਰ ਪਾਕ ਅਤੇ ਹੋਰ ਵੀ ਬਹੁਤ ਕੁਝ ਬਣਾਉਣਾ ਸਿੱਖਿਆ ਜੋ ਮੈਨੂੰ ਬਹੁਤ ਚੰਗਾ ਲੱਗਿਆ ਮੇਰੇ ਲਈ ਇਹ ਵਧੀਆ ਯਾਦਗਾਰ ਸੀ